ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਰਅਸਲ ਮੈਂ ਬਾਹਰੋਂ ਬ ਬਨਾਰਸ ਤੋਂ ਆਇਆ ਵਾਂ ਅਤੇ ਇੱਥੇ ਅਜੀਤ ਸਿੰਘ ਨੇ ਨੰਬਰ ਦਿੱਤਾ ਤੁਹਾਡਾ ਮੈਂ ਸ਼ਹਿਰ 'ਚ ਘੁੰਮਣ ਫਿਰਨ ਆਇਆ ਅਤੇ ਗੁਰਦੁਆਰਿਆਂ ਦੇ ਹੋਰ ਜਗ੍ਹਾ ਦੇ ਦਰਸ਼ਨ ਦੀਦਾਰੇ ਕਰਨੇ ਨੇ ਤਾਂ ਤੁਸੀਂ ਮੈਨੂੰ ਜਗ੍ਹਾ ਦੱਸੋ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਜਾਵਾਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਇਹ ਕਿਹੜੇ ਪਾਸੇ ਨੇ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਨਾਲ ਨਾਲ ਹੀ ਨੇ ਠੀਕ ਹੈ ਠੀਕ ਹੈ ਔਰ ਇੱਥੇ ਕੋਈ ਦੇ ਦੇਖਣ ਲਈ ਚੀਜ਼ ਹੈਗੀ ਕੋਈ

ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ

ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ